ਹੈਲੋ ਵਧੀਆ ਤੂੰ ਦੱਸ ਅੱਛਾ ਹਾਂਜੀ ਹਾਂਜੀ ਹਾਂਜੀ ਪਹਿਲਾਂ ਤਾਂ ਹੈਲੋ ਮੈਂ ਵੀ ਮੈਨੂੰ ਤਾਂ ਸਾਲ ਹੋ ਗਿਆ ਮੈਂ ਉਥੋਂ ਦਾ ਪੁਰਾਣਾ ਸਟੂਡੈਂਟ ਸੀ ਅਤੇ ਉਹ ਹੁਣ ਤਾਂ ਕਾਫੀ ਯਾਨੀ ਕਿ ਚੇਜਿੰਗ ਹੋਈ ਆ ਮੌਸਮ ਠੀਕ ਰਹਿੰਦਾ ਗਾ ਵਧੀਆ ਰਹਿ ਰਿਹਾ ਗਾ ਮੀਂਹ ਵਗੈਰਾ ਪੈਂਦਾ ਰਹਿੰਦਾ ਗਾ ਨਹੀਂ ਨਹੀਂ ਨਹੀਂ ਨਹੀਂ ਹ ਹਲੇ ਇਸ ਟਾਈਮ ਹਾਲੇ ਵਧੀਆ ਚੱਲ ਰਿਹਾ ਗਾ ਨੋਰਮਲ ਚੱਲ ਰਿਹਾ ਗਾ ਮੌਸਮ ਆਪਣੇ ਉਸ ਅਕੋਰਡਿੰਗ ਨਹੀਂ ਠੀਕ ਹੈ ਕਦੇ ਕਦੇ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਤਾਂ ਉਸਦੇ ਲਈ ਆਪਣਾ ਇੱਕ ਛੱਤਰੀ ਆਪਣੇ ਨਾਲ ਲੈ ਕੇ ਆਇਓ ਅੰਬਰੇਲਾ ਸੂਟ ਵੀ ਲੈ ਕੇ ਆਇਓ ਤੁਸੀਂ ਅਤੇ ਆਪਣੇ ਨਾਲ ਹੈਨਾ ਜਾਨੀ ਕਿ ਫੁੱਲ ਸਲੀਵਜ਼ ਵਾਲੇ ਹੈਨਾ ਕੱਪੜੇ ਲੈ ਕੇ ਆਇਓ ਕਿਉਂਕਿ ਫਿਰ ਜਦੋਂ ਆਪਣੇ ਉਰੇ ਬਾਰਿਸ਼ ਵਗੈਰਾ ਹੁੰਦੀ ਹੈ ਤਾਂ ਉਹ ਉਹਦੇ ਕਾਰਨ ਮੱਛਰ ਵਗੈਰਾ ਕਈ ਵਾਰ ਜ਼ਿਆਦਾ ਹੋ ਜਾਂਦਾ ਨਾ ਉੱਤੋਂ ਫਿਰ ਪੂਰੀ ਬਾਹਵਾਂ ਦੇ ਜ਼ਿਆਦਾ ਕੱਪੜੇ ਲੈ ਕੇ ਆਇਓ ਹਾਂਜੀ ਹੋਰ ਕੋਈ ਪੁੱਛਣਾ ਹੋਵੇ ਓਕੇ ਜੀ ਧੰਨਵਾਦ